ਲੋਕ ਵਿਆਹ ਵਿੱਚ ਲਾੜੀ ਨੂੰ ਬਹੁਤ ਸਾਰੇ ਤੋਹਫ਼ੇ ਦਿੰਦੇ ਹਨ ਜਿਵੇਂ ਕਿ ਉਸ ਦੇ ਘਰ ਵਾਲੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਉਹਨੂੰ ਪਿਆਰ ਵਜੋਂ ਬਹੁਤ ਸਾਰੀਆਂ ਭੇਟਾਂ ਦਿੰਦੇ ਹਨ ਉਨ੍ਹਾਂ ਵਿੱਚ ਉਸ ਦੇ ਪਰਿਵਾਰ ਵਾਲੇ ਉਸ ਦੀਆਂ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਹੋਣ ਵਾਲੀਆਂਂ ਬਹੁਤ ਸਾਰੀਆਂ ਚੀਜ਼ਾਂ ਭੇਟ ਕਰਦੇ ਹਨ ਜਿਵੇਂ ਕਿ ਬੈੱਡ ਅਲਮਾਰੀ ਸੌਫ਼ਾ ਕੱਪੜੇ ਧੌਣ ਵਾਲੀ ਮਸ਼ੀਨ ਸਿਲਾਈ ਮਸ਼ੀਨ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਉਸਦੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਹੋਣੀਆਂ ਹੁੰਦੀਆਂ ਹਨ ਔਰ ਉਸ ਨੂੰ ਸ਼ਗਨ ਵਜੋਂ ਵੀ ਬਹੁਤ ਸਾਰੀਆਂ ਭੇਟਾਂ ਦਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਉਸ ਦੇ ਕੱਪੜੇ ਸ਼ਾਮਿਲ ਹੁੰਦੇ ਹਨ ਉਸ ਦੇ ਚੱਪਲਾਂ ਜੁੱਤੇ ਔਰ ਹਾਰ ਸ਼ਿੰਗਾਰ ਦਾ ਬਹੁਤ ਸਾਰਾ ਸਮਾਨ ਜੋ ਕਿ ਉਸ ਨੇ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਕਰਨਾ ਹੁੰਦਾ ਹੈ ਔਰ ਉਸ ਦੇ ਦੋਸਤ ਤੇ ਅਤੇ ਰਿਸ਼ਤੇਦਾਰ ਉਸ ਦੀਆਂ ਮਨਪਸੰਦ ਕੋਈ ਨਾ ਕੋਈ ਚੀਜ਼ ਉਸ ਨੂੰ ਪਿਆਰ ਵਜੋਂ ਭੇਟ ਕਰਦੇ ਹਨ ਜੋ ਕਿ ਉਸ ਨੂੰ ਵਿਆਹ 'ਤੇ ਦਿੱਤੀ ਜਾਂਦੀ ਹੈ ਆਪਣਾ ਪਿਆਰ ਪ੍ਰਗਟਾਉਣ ਲਈ ਸਾਰੇ ਉਸ ਨੂੰ ਕੁਛ ਨਾ ਕੁਛ ਤੋਹਫ਼ੇ ਵਿੱਚ ਦਿੰਦੇ ਹਨ ਅਤੇ ਉਸ ਨੂੰ ਸ਼ਗਨ ਵੀ ਪਾਇਆ ਜਾਂਦਾ ਹੈ ਜਿਸ ਵਿੱਚ ਕੁਛ ਪੈਸੇ ਵੀ ਸ਼ਾਮਿਲ ਹੁੰਦੇ ਹਨ ਇਸ ਨਾਲ ਲਾੜੀ ਦੇ ਵਿਆਹ ਵਿੱਚ ਉਸ ਨੂੰ ਬਹੁਤ ਸਾਰੇ ਤੋਹਫ਼ੇ ਮਿਲਦੇ ਹਨ ਇਹ ਸਾਰਿਆਂ ਦਾ ਪਿਆਰ ਹੁੰਦਾ ਹੈ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਧੰਨਵਾਦ